ਪਰਿਵਾਰ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਦੀ ਬੜੀ ਅਹਿਮ ਭੂਮਿਕਾ ਹੁੰਦੀ ਹੈ ਇੱਕ ਆਦਮੀ ਜੋ ਹੁੰਦਾ ਹੈ ਉਹ ਪਰਿਵਾਰ ਦੇ ਵਿੱਚ ਕਹਿ ਲਓ ਜਿਵੇਂ ਰੁੱਖ ਦੀਆਂ ਜੜ੍ਹਾਂ ਹੁੰਦੀਆਂ ਨੇ ਤਾਂ ਇੱਕ ਜੜ੍ਹਾਂ ਦੀ ਤਰ੍ਹਾਂ ਕੰਮ ਕਰਦਾ ਹੈ ਕਿ ਸਾਰੇ ਰੁੱਖ ਨੂੰ ਮਜ਼ਬੂਤੀ ਦੇ ਨਾਲ ਧਰਤੀ ਦੇ ਨਾਲ ਜੋੜ ਕੇ ਰੱਖਦਾ ਹੈ ਅਤੇ ਔਰਤ ਜਿਹੜੀ ਹੈ ਉਸ ਰੁੱਖ ਦੇ ਤਣੇ ਦੀ ਤਰ੍ਹਾਂ ਹੁੰਦੀ ਹੈ ਜਿਹਨੇ ਕਿ ਸਾਰੀਆਂ ਜਿਹੜੀਆਂ ਹੈਗੀਆਂ ਟਾਹਣੀਆਂ ਨੂੰ ਜਾਂ ਸਾਰੇ ਰਿਸ਼ਤੇ ਰਿਸ਼ਤਿਆਂ ਨੂੰ ਆਪਸ 'ਚ ਜੋੜ ਕੇ ਰੱਖਿਆ ਹੋਇਆ ਹੁੰਦਾ ਹੈ ਆਦਮੀ ਔਰਤ ਜਿਹੜੇ ਨੇ ਇਹਨਾਂ ਨੇ ਆਪਦੇ ਪਰਿਵਾਰ ਦੇ ਸਾਰੇ ਕੰਮ ਆਪਸ 'ਚ ਵੰਡੇ ਹੋਏ ਹੁੰਦੇ ਨੇ ਜਿਵੇਂ ਜਿਹੜਾ ਆਦਮੀ ਹੈ ਉਹ ਬਾਹਰ ਜਾਂਦਾ ਹੈ ਕੰਮ ਕਰਦਾ ਹੈ ਕਮਾਈ ਕਰਕੇ ਅਨਾਜ ਘਰੇ ਲਿਆਉਂਦਾ ਹੈ ਰਾਸ਼ਨ ਪਾਣੀ ਘਰ ਲਿਆਉਂਦਾ ਹੈ ਅਤੇ ਔਰਤ ਜਿਹੜੀ ਹੈਗੀ ਹੈ ਉਸ ਰਾਸ਼ਨ ਤੋਂ ਭੋਜਨ ਬਣਾਉਂਦੀ ਹੈ ਉਸ ਅਨਾਜ ਤੋਂ ਭੋਜਨ ਬਣਾਉਂਦੀ ਹੈ ਅਤੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਮਾਂ ਪਿਓ ਨੂੰ ਆਪਣੇ ਪਤੀ ਨੂੰ ਸਾਂਭਦੀ ਹੈ ਉਹਨਾਂ ਦੀ ਸੇਵਾ ਕਰਦੀ ਹੈ ਪਰਿਵਾਰ ਵਿੱਚ ਮਰਦ ਅਤੇ ਔਰਤ ਦੇ ਕੰਮ ਕੁਛ ਇਸ ਹਿਸਾਬ ਦੇ ਨਾਲ ਵੰਡੇ ਹੋਏ ਹਨ ਅਤੇ ਇਹਨਾਂ ਦੀਆਂ ਭੂਮਿਕਾਵਾਂ ਸਮੇਂ ਦੀ ਮੰਗ ਅਨੁਸਾਰ ਵਿਕਸਿਤ ਵੀ ਹੋਈਆਂ ਕਿ ਪਹਿਲਾਂ ਕੀ ਹੁੰਦਾ ਸੀ ਕਿ ਸਿਰਫ਼ ਆਦਮੀ ਜਿਹੜੇ ਸੀ ਉਹ ਹੀ ਬਾਹਰ ਕੰਮ ਕਰਨ ਲਈ ਜਾਂਦੇ ਸੀ ਅਤੇ ਔਰਤਾਂ ਦਾ ਮੇਨ ਜਿਹੜਾ ਧਿਆਨ ਹੁੰਦਾ ਸੀ ਉਹ ਸਿਰਫ਼ ਆਪਦੇ ਪਰਿਵਾਰ ਦੇ ਪਾਲਣ ਪੋਸ਼ਣ 'ਤੇ ਹੀ ਹੁੰਦਾ ਸੀ ਪਰ ਅੱਜ ਕੱਲ੍ਹ ਸਮੇਂ ਦੀ ਮੰਗ ਅਨੁਸਾਰ ਔਰਤਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਆਪਣੇ ਪਤੀ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਬਾਹਰ ਕੰਮ ਕਰਦੀਆਂ ਨੇ ਕਮਾਈ ਕਰਦੀਆਂ ਨੇ ਅਤੇ ਦੋਨਾਂ ਦੇ ਮਨਾਂ ਦੇ ਵਿੱਚ ਆਪਸੀ ਸਮਝ ਦੇ ਨਾਲ ਆਪਸੀ ਕਹਿ ਲਓ ਕਿ ਸਤਿਕਾਰ ਦੇ ਕਰਕੇ ਜਿਹੜੇ ਹੈਗੇ ਨੇ ਘਰ ਦੇ ਕੋਈ ਵੀ ਕੰਮ ਹੈਗਾ ਵਾ ਜਿਹੜਾ ਜੇ ਔਰਤ ਜਿਹੜੀ ਹੈ ਉਹ ਬਾਹਰ ਜਾ ਕੇ ਕੰਮ ਕਰਨਾ ਵਿੱਚ ਹੁਣ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸ਼ਰਮ ਮਹਿਸੂਸ ਨਹੀਂ ਕਰਦੀ ਤਾਂ ਆਦਮੀ ਜਿਹੜਾ ਹੈ ਉਹ ਵੀ ਉੰਨੇ ਹੀ ਖੁਲਾਸੇ ਢੰਗ ਦੇ ਨਾਲ ਕਹਿ ਲਓ ਘਰ ਦੇ ਕੰਮਾਂ ਦੇ ਵਿੱਚ ਉਹਦਾ ਹੱਥ ਵਟਾ ਰਿਹਾ ਹੈ